ਟੈਕਨੋਲਜੀ ਨੇ ਸਾ ਸਾਡੇ ਜੀਵਨ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ ਜਿਵੇਂ ਕਿ ਪਹਿਲੇ ਸਾਨੂੰ ਟਿਕਟ ਬੁ ਟਿਕਟਾਂ ਲੈਣ ਲਈ ਕਤਾਰਾਂ ਵਿੱਚ ਲੱਗਣਾ ਪੈਂਦਾ ਸੀ ਜਾਂ ਲਾਈਨਾਂ ਵਿੱਚ ਲੱਗਣਾ ਪੈਂਦਾ ਸੀ ਪਰ ਅੱਜ ਕੱਲ੍ਹ ਅਸੀਂ ਇਸ ਨੂੰ ਓਨਲਾਈਨ ਮੋਬੈਲ 'ਤੇ ਵੀ ਬੁੱਕ ਕਰ ਸਕਦੇ ਹਾਂ ਜਿਹਦੇ ਨਾਲ ਸ ਸਾਨੂੰ ਬਹੁਤ ਜ਼ਿਆਦਾ ਮਦਦ ਮਿਲਦੀ ਹੈ ਅਤੇ ਸੌਖੇ ਤਰੀਕੇ ਨਾਲ ਅਸੀਂ ਕਰ ਸਕਦੇ ਇਹ ਵੀ ਸਾਨੂੰ ਪਤਾ ਪਹਿਲੇ ਪਤਾ ਲੱਗ ਜਾਂਦਾ ਹੈ ਕਿ ਕਿੰਨੇ ਦੇ ਕਿੰਨੀ ਤਰੀਕ ਦੀ ਟਿਕਟ ਹੈ ਕਿੰਨੀਆਂ ਸੀਟਾਂ ਫੁੱਲ ਹੈ ਜਾਂ ਰਹਿੰਦੀਆਂ ਹੈ ਕਿੰਨੇ ਵਜੇ ਦੇ ਦੀ ਬੁੱਕ ਹੈ ਕਿਹੜੀ ਤਰੀਕ ਦੀ ਕਰਨੀ ਉਹ ਸਾਨੂੰ ਸਭ ਪਹਿਲੇ ਪਤਾ ਲੱਗ ਜਾਂਦਾ ਤਾਂ ਅਸੀਂ ਉਸ ਹਿਸਾਬ ਨਾਲ ਆਪਣੀ ਟਿਕਟ ਬੁਕਿੰਗ ਕਰ ਸਕਦੇ ਹਾਂ ਇਸੇ ਤਰ੍ਹਾਂ ਹੋਟਲ ਬੁਕਿੰਗ ਵਿੱਚ ਵੀ ਸਾਨੂੰ ਬਹੁਤ ਅਸਾਨੀ ਹੋਈ ਹੈ ਹੁਣ ਤਰੀਕੇ ਨਾਲ ਅਸੀਂ ਪਹਿਲੇ ਹੀ ਚੈੱਕ ਕਰ ਸਕਦੇ ਹਾਂ ਕਿ ਹੋਟਲ ਕਿਸ ਕਿਸ ਕਿਸ ਤਰ੍ਹਾਂ ਦਾ ਹੈ ਕਿੰਨੇ ਕਿੰਨਾ ਵਧੀਆ ਹੈ ਜਾਂ ਘਟੀਆ ਹੈ ਕਿਸ ਤਰ੍ਹਾਂ ਦਾ ਇੱਥੇ ਖਾਣਾ ਮਿਲਦਾ ਹੈ ਉਹ ਸਾਨੂੰ ਸਭ ਪਹਿਲਾਂ ਹੀ ਪਤਾ ਚ ਲੱਗ ਜਾਂਦਾ ਹੈ ਇਸ ਲਈ ਨਵੀਂ ਟੈਕਨੋਲਜੀ ਨੇ ਸਾਡੇ ਜੀਵਨ ਵਿੱਚ ਬਹੁਤ ਵਧੀਆ ਥਾਂ ਬਣਾਈ ਹੈ ਇਸੇ ਤਰ੍ਹਾਂ ਰੇਲਵੇ ਪਲੇਟਫੋਰਮ ਨੰਬਰ ਪਹਿਲੇ ਸਾਨੂੰ ਮੈਨਸ਼ਨ ਕੀਤਾ ਜਾਂਦਾ ਹੈ ਸਾਰੀ ਵਿੱਚ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਟਰੇਨ ਕਿੰਨੇ ਵਜੇ ਜਾਣੀ ਹੈ ਕਿਹੜਾ ਪਲੇਟਫੋਰਮ ਹੈ ਨੰਬਰ ਹੈ ਕਿੱਥੇ ਰੁਕਣੀ ਹੈ ਕਿੰਨੇ ਟੈਮ 'ਤੇ ਕਿੱਥੇ ਪੁੱਜਣੀ ਹੈ ਉਹਦੀ ਲੋਕੇਸ਼ਨ ਸਾਨੂੰ ਪਹਿਲੇ ਹੀ ਮਿਲ ਜਾਂਦੀ ਹੈ ਬੱਸ ਵਿੱਚ ਵੀ ਐਵੇਂ ਹੀ ਅੱਜ ਕੱਲ੍ਹ ਟਕਨੋਲਜੀ ਦੇ ਬਹੁਤ ਵਧੀਆ ਸੁਧਾਰ ਹੋਇਆ ਹੈ ਇਸ ਨਾਲ ਸਾਨੂੰ ਆਵਾਜਾਈ ਵਿੱਚ ਬਹੁਤ ਵਧੀਆ ਬਹੁਤ ਵਧੀਆ ਦੇਖਣ ਨੂੰ ਮਿਲਿਆ ਹੈ ਟੈਕਨੋਲਜੀ ਨੇ ਸ ਸਾਡੀ ਨਿੱਜੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ ਇਹਦੇ ਨਾਲ ਅਸੀਂ ਅੱਜ ਦੇ ਟਾਈਮ ਵਿੱਚ ਬਹੁਤ ਵਧੀਆ ਕੰਮ ਕਰ ਸ ਸਕਦੇ ਹਾਂ